ਪੰਜਾਬੀ ਪਰਿਵਾਰ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਅਤੇ ਫਿਰ ਪਰਿਵਾਰ ਵਿੱਚੋਂ ਕਿਸੇ ਇੱਕ ਵੱਡਾ ਜਿਹੜਾ ਜੀਅ ਹੁੰਦਾ ਹੈਗਾ ਉਹਨੂੰ ਉਹ ਗੁੜਤੀ ਦਿੰਦਾ ਹੈਗਾ ਬੱਚੇ ਨੂੰ ਤਾਂ ਜੋ ਸਾਰੀਆਂ ਆਦਤਾਂ ਜਿਹੜੀਆਂ ਹੈਗੀਆਂ ਬੱਚੇ ਦੀਆਂ ਉਸਦੇ ਉੱਪਰ ਜਾਣ ਉਸ ਤੋਂ ਬਾਅਦ ਨਿੰਮ ਬੰਨ੍ਹਣ ਦੀ ਰਸਮ ਹੁੰਦੀ ਹੈ ਜਿਹਦੇ ਵਿੱਚ ਸਾਰੇ ਪਰਿਵਾਰ ਇਕੱਠਾ ਹੋ ਕੇ ਨਿੰਮ ਤਿਆਰ ਕਰਦਾ ਜਿਸ ਵਿੱਚ ਗੁਬਾਰੇ ਖਿਡਾਉਣੇ ਸਾ ਅਤੇ ਸ਼ਗਨ ਦੀਆਂ ਸਾਰੀਆਂ ਚੀਜ਼ਾਂ ਬੰਨ੍ਹੀਆਂ ਜਾਂਦੀਆਂ ਹਨ ਫਿਰ ਸਾਰਾ ਪਰਿਵਾਰ ਸ਼ਰੀਕਾ ਆਂਢ ਗੁਆਂਢ ਸਾਰੇ ਮਿਲ ਕੇ ਓ ਨਿੰਮ ਬੰਨ੍ਹਦੇ ਹਨ ਸ਼ਗਨ ਮਨਾਉਂਦੇ ਹਨ ਗੁੜ ਵੰਡਦੇ ਹਨ ਪਤਾਸੇ ਵੰਡਦੇ ਹਨ ਉਸ ਤੋਂ ਬਾਅਦ ਜਦੋਂ ਬੱਚੇ ਬੱਚੇ ਦੇ ਜਨਮ ਨੂੰ ਪੰਜ ਜਾਂ ਗਿਆਰਾਂ ਦਿਨ ਹੋ ਜਾਂਦੇ ਹਨ ਤਾਂ ਮਾਮੇ ਵਧਾਈ ਲੈ ਕੇ ਜਾਂਦੇ ਹਨ ਅਤੇ ਉੱਥੇ ਉਹਨਾਂ ਦਾ ਪੂਰਾ ਮਾਣ ਤਾਣ ਕੀਤਾ ਜਾਂਦਾ ਹੈ ਉਹਨਾਂ ਨੂੰ ਨੂੰ ਮਤਲਬ ਇੱਕ ਸ਼ਗਨ ਦੇ ਤੌਰ 'ਤੇ ਇੱਕ ਰਸਮ ਮਨਾਈ ਜਾਂਦੀ ਹੈ ਜਿਹਨੂੰ ਵਧਾਈ ਕਹਿੰਦੇ ਹਨ ਵਧਾਈ ਲੈ ਕੇ ਗਿਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ ਅਤੇ ਕੱਪੜੇ ਜਾਂ ਖੇਸ ਵਗੈਰਾ ਸਾਰਾ ਕੁਝ ਦੇ ਕੇ ਉਹਨਾਂ ਦਾ ਮਾਣ ਤਾਣ ਕੀਤਾ ਜਾਂਦਾ ਹੈ ਅਤੇ ਬੱਚੇ ਦੇ ਜਨਮ ਵੇਲੇ ਪੰਜ ਸੂਟ ਬੱਚੇ ਦੇ ਜੋ ਕਿ ਭੂਆ ਵੱਲੋਂ ਜਾਂ ਚਾਚੇ ਤਾਇਆਂ ਵੱਲੋਂ ਸਾਰਿਆਂ ਵੱਲੋਂ ਬੱਚੇ ਨੂੰ ਇੱਕ ਨਵੇਂ ਜੀਅ ਦੇ ਤੌਰ 'ਤੇ ਤੋਹਫ਼ੇ ਦੇ ਵਜੋਂ ਦਿੱਤੇ ਜਾਂਦੇ ਹਨ ਅਤੇ ਛੋਟੇ ਬੱਚੇ ਦੇ ਉਪ ਹੱਥ ਉੱਪਰ ਕਾਲਾ ਧਾਗਾ ਬੰਨ੍ਹਿਆ ਜਾਂਦਾ ਹੈ ਤਾਂ ਜੋ ਉਸਨੂੰ ਨਜ਼ਰ ਤੋਂ ਬਚਾਇਆ ਜਾ ਸਕੇ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਇਹ ਖੁਸ਼ੀਆਂ ਮਨਾਉਂਦੇ ਹਨ ਅਤੇ ਗੁੜ ਅਤੇ ਸ਼ੱਕ ਅ ਗੁੜ ਅਤੇ ਪਤਾਸੇ ਇਸ ਰਸਮ ਦੇ ਵਿੱਚ ਵੰਡੇ ਜਾਂਦੇ ਹਨ ਤਾਂ ਮਤਲਬ ਪੂਰਾ ਜਿਹੜਾ ਹੈਗਾ ਸ਼ਗਨ ਦੇ ਤੌਰ 'ਤੇ ਪੂਰਾ ਜਿਹੜੀ ਰਸਮ ਹੈਗੀ ਹੈ ਚੰਗੀ ਤਰ੍ਹਾਂ ਮਨਾਈ ਜਾ ਸਕੇ